ਇਹੋ ਜਿਹਾ ਕੋਈ ਪਕਵਾਨ ਨਹੀਂ ਹੈ ਜੋ ਕਿ ਮੈਂ ਟਰਾਏ ਨਹੀਂ ਕੀਤਾ ਪਰ ਪਰ ਮਸ਼ਰੂਮ ਸੀ ਮਸ਼ਰੂਮ ਸਾਨੂੰ ਪਸੰਦ ਨਹੀਂ ਮੇਰੀ ਫੈਮਿਲੀ ਮੈਬਰਸ ਨੂੰ ਪਸੰਦ ਨਹੀਂ ਅਤੇ ਮੈਂ ਉਹ ਕੋਸ਼ਿਸ਼ ਕਰਨਾ ਚਾਹੁੰਦੀ ਹਾਂ ਕਿਉਂਕਿ ਅਸੀਂ ਨੌਨ ਵੇਜ ਮੀਟ ਮੱਛੀ ਵਗੈਰਾ ਆਦਿ ਨਹੀਂ ਖਾਂਦੇ ਬਿਕੌਸ ਅਸੀਂ ਸਾਡੀ ਫੈਮਿਲੀ ਮੈਬਰਸ ਨੇ ਅੰਮ੍ਰਿਤ ਛਕਿਆ ਹੋਇਆ ਹੈ ਸੋ ਅਸੀਂ ਨੌਨ ਵੇਜ ਖਾਂਦੇ ਨਹੀਂ ਅਤੇ ਮੈਂ ਮਸ਼ਰੂਮ ਨੂੰ ਟਰਾਈ ਕਰਨਾ ਚਾਹੁੰਦੀ ਹਾਂ ਮੈਂ ਅਸੀਂ ਮਸ਼ਰੂਮ ਵੀ ਨਹੀਂ ਖਾਣਾ ਕਿਉਂਕਿ ਬਿਕੌਸ ਇਹ ਥੋੜ੍ਹਾ ਮੱਛੀ ਟਾਈਪ ਮਤਲਬ ਨੌਨ ਵੇਜ ਟਾਈਪ ਦਾ ਹੁੰਦਾ ਹੈ ਸੋ ਮੈਂ ਫਸਟ ਟਾਈਮ ਆਹ ਟਰਾਈ ਕਰਾਂਗੀ ਜੋ ਕਿ ਮੈਂ ਆਪਣੀ ਯੂਟਿਊਬ ਤੋਂ ਦੇਸੀ ਰਸੋਈ ਤੋਂ ਸਿੱਖਿਆ ਹੋਇਆ ਸੀ ਅਤੇ ਮੈਂ ਚਾਹੁੰਦੀ ਸੀ ਕਿ ਇਸ ਨੂੰ ਟਰਾਈ ਕਰਾਂ ਬਿਕੌਸ ਮਾਈ ਫੈਮਿਲੀ ਮੈਬਰਸ ਨਹੀਂ ਖਾਂਦੇ ਤਾਂ ਮੈਂ ਇਸ ਨੂੰ ਟਰਾਈ ਕਰਨਾ ਚਾਹੁੰਦੀ ਹਾਂ ਅਤੇ ਅੱਜ ਮੈਂ ਇਸ ਨੂੰ ਟਰਾਈ ਕਰਨਾ ਚਾਹਾਂਗੀ ਫਸਟ ਮੈਂ ਮਸ਼ਰੂਮ ਲਏ ਮਸ਼ਰੂਮ ਲਏ ਫਿਰ ਉਸ ਨੂੰ ਕੱਟਿਆ ਅਤੇ ਪਨੀ ਮਟਰ ਲਿੱਤੇ ਅਤੇ ਉਸ ਨੂੰ ਉਸ ਲਈ ਪਨ ਤਿਆਰ ਕੀਤਾ ਪਿਆਜ਼ ਲਸਣ ਅਦਰਕ ਆਦਿ ਨੂੰ ਕੱਟਿਆ ਅਤੇ ਗ੍ਰਾਈਂਡ ਕਰਕੇ ਉਸ ਨੂੰ ਤੇਲ ਵਿੱਚ ਪਾਇਆ ਅਤੇ ਤੇਲ ਵਿੱਚ ਉਸ ਨੂੰ ਭੁੰਨਿਆ ਅਤੇ ਉਸ ਵਿੱਚ ਮਟਰ ਆਲੂ ਵਗੈਰਾ ਪਾਏ ਅਤੇ ਉਸ ਨੂੰ ਚੰਗੀ ਤਰ੍ਹਾਂ ਤੜਕ ਕੇ ਫਿਰ ਉਸ ਵਿੱਚ ਮਸ਼ਰੂਮ ਨੂੰ ਪਾਇਆ ਅਤੇ ਉਸ ਉਸ ਮਸ਼ਰੂਮ ਨੂੰ ਪਾ ਕੇ ਫਿਰ ਕੁੱਕਰ ਨੂੰ ਬੰਦ ਕਰ ਦਿੱਤਾ ਅਤੇ ਜਿਸ ਨਾਲ਼ ਮਸ਼ਰੂਮ ਤਿਆਰ ਹੋ ਗਏ ਅਸੀਂ ਇਸ ਨੂੰ ਫਸਟ ਟਾਈਮ ਖਾਵਾਂਗੇ ਕਿਉਂਕਿ ਅਸੀਂ ਕਦੇ ਇਸਨੂੰ ਪਸੰਦ ਨਹੀਂ ਕਰਦੇ ਅਤੇ ਨਾ ਹੀ ਅਸੀਂ ਕਦੇ ਖਾਧਾ ਇਹ ਸੋ ਅਸੀਂ ਇਸ ਨੂੰ ਫਸਟ ਟਾਈਮ ਖਾਵਾਂਗੇ ਅਤੇ ਅਸੀਂ ਦੇਖਾਂਗੇ ਕਿ ਕਿਵੇਂ ਦਾ ਹੈ ਟੇਸਟੀ ਹੈ ਜਾਂ ਨਹੀਂ ਅਤੇ ਇਹ ਮੁਸ਼ਕਲ ਪਕਵਾਨ ਹੈ ਜੋ ਕਿ ਮੈਂ ਕਦੇ ਟਰਾਈ ਨਹੀਂ ਕੀਤਾ ਅਤੇ ਮੈ ਇਹਨੂੰ ਇਸਨੂੰ ਟਰਾਈ ਕੀਤਾ ਹੈ ਅੱਜ ਫਸਟ ਡੇ